ਪੁਰਾਣੇ ਸਮੇਂ ਵਿੱਚ ਨਾ ਖੂਹ ਜਿਹੜੇ ਹੁੰਦੇ ਸੀਗੇ ਉਹ ਇੱਕ ਪਿੰਡ ਦੇ ਵਿੱਚ ਸਾਂਝੀ ਜਗ੍ਹਾ 'ਤੇ ਬਣਾਏ ਜਾਂਦੇ ਸੀ ਜਿੱਥੇ ਪਿੰਡ ਦੇ ਪੁਰਾਣੇ ਬਜ਼ੁਰਗ ਲਾ ਲੋ ਉਹ ਜ਼ਿਆਦਾਤਰ ਉੱਥੇ ਔਰਤਾਂ ਜਿ ਜਿਹੜੀਆਂ ਜਾਂਦੀਆਂ ਸੀ ਉਹ ਘਰਾਂ ਦੇ ਆਪਣੇ ਭਾਂਡੇ ਜਿਵੇਂ ਉਨ੍ਹਾਂ ਦੇ ਭਾਂਡੇ ਹੁੰਦੇ ਸੀ ਵਲਟੋਹੀਆਂ ਗਾਗਰਾਂ ਬਾਲਟੀਆਂ ਉਹ ਸਾਰੀਆਂ ਚੀਜ਼ਾਂ ਜਿਹਨਾਂ ਕੋਲ ਵੀ ਜਿਹੜਾ ਸਮਾਨ ਭਾਂਡੇ ਅਵੇਲੇਬਲ ਹੁੰਦੇ ਸੀ ਉਹ ਆਪਣੇ ਭਾਂਡਿਆਂ ਨੂੰ ਲੈ ਕੇ ਉੱਥੇ ਖੂਹਾਂ ਤੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਸੀਗੀਆਂ ਜਿਹੜੇ ਖੂਹ ਸੀ ਉਹਨਾਂ ਦਾ ਪਾਣੀ ਵੀ ਬਹੁਤ ਸਾਫ ਸੁਥਰਾ ਪਾਣੀ ਸੀਗਾ ਉਹਨਾਂ ਦਾ ਅਤੇ ਅੱਜ ਕੱਲ੍ਹ ਇਹ ਖੂਹ ਨੇ ਜਿਹੜੇ ਸਾਨੂੰ ਇਹ ਦੇਖਣ ਨੂੰ ਕੋਈ ਟਾਵਾਂ ਵਿਰਲਾ ਖੂਹ ਮਿਲਦਾ ਜਦਕਿ ਹੁਣ ਤਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਵੀ ਖੂਹ ਹੁੰਦੇ ਕੀ ਨੇ ਹੈ ਨਾ ਜਿਹੜੇ ਖੂਹ ਹੁੰਦੇ ਸੀਗੇ ਉਹਨਾਂ ਤੋਂ ਸਾਰਿਆਂ ਨੇ ਸ਼ੌਂਕ ਦੇ ਨਾਲ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਬਜ਼ੁਰਗਾਂ ਨੇ ਖਾਸ ਕਰ ਬੀਬੀਆਂ ਨੇ ਸੌਂਕ ਦੇ ਨਾਲ ਆਪਣਾ ਪਾਣੀ ਭਰਨ ਜਾਣਾ ਅਤੇ ਜਦੋਂ ਪਾਣੀ ਭਰਨ ਜਾਂਦੇ ਸੀ ਇੱਕ ਤਰ੍ਹਾਂ ਦੀ ਉਹਨਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਸੀਗੀ ਅਤੇ ਉਹ ਆਪਣੇ ਨਾਲ ਦੀਆਂ ਬੀਬੀਆਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਬਾਤਾਂ ਸ਼ੇਅਰ ਵੀ ਕਰ ਲੈਂਦੀਆਂ ਸੀਗੀਆਂ ਹੈ ਨਾ ਜਿਹੜੇ ਪਾਣੀ ਆ ਖੂਹ ਆ ਜਿਹੜਾ ਖੂਹ ਦੇ ਵਿੱਚ ਇੱਕ ਲੱਜ ਹੁੰਦੀ ਸੀ ਲੱਜ ਦੇ ਨਾਲ ਇੱਕ ਬਾਲਟੀ ਬੰਨ੍ਹੀ ਜਾਂਦੀ ਸੀ ਉਹ ਬਾਲਟੀ ਦੇ ਨਾਲ ਉਹ ਜੋਰ ਲਗਾ ਕੇ ਬਾਲਟੀ ਨੂੰ ਪਹਿਲਾਂ ਹੇਠਾਂ ਸੁੱਟਦੇ ਸੀ ਬਾ ਬਾਚੋਂ ਦੋਨੋਂ ਹੱਥਾਂ ਦੇ ਨਾਲ ਉਹ ਖਿੱਚ ਕੇ ਐਕਸਸਾਈਜ਼ ਨਾਲੇ ਉਹਨਾਂ ਦੀ ਹੁੰਦੀ ਸੀ ਖਿੱਚ ਕੇ ਉਹ ਪਾਣੀ ਕੱਢਿਆ ਜਾਂਦਾ ਸੀ ਅਤੇ ਪਾਣੀ ਫਿਰ ਉਹ ਆਪਣੇ ਗਾਗਰਾਂ 'ਚ ਘੜਿਆਂ 'ਚ ਭਰਿਆ ਜਾਂਦਾ ਸੀ ਅਤੇ ਫਿਰ ਬੀਬੀਆਂ ਨੇ ਜਿਹੜੀਆਂ ਉਹ ਇੱਕੋ ਦੂਜੇ ਨੂੰ ਚੁਕਾਉਂਦੀਆਂ ਵੀ ਹੁੰਦੀਆਂ ਸੀ ਪਾਣੀ ਹੈ ਨਾ ਤਾਂ ਉਹ ਸਿਰ 'ਤੇ ਆਪਣਾ ਇੱਕ ਇਨੂਆ ਜਿਹਾ ਰੱਖ ਲੈਂਦੀਆਂ ਸੀ ਇਨੂਆ ਰੱਖ ਕੇ ਸਿਰ 'ਤੇ ਆਪਣੀ ਗਾਗਰਾਂ ਵੀ ਲੈ ਕੇ ਆਉਂਦੀਆਂ ਸੀਗੀਆਂ ਹੈ ਨਾ ਪਾਣੀ ਦੀਆਂ ਭਰ ਕੇ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਵੀ ਹੈਲਪ ਕਰਾ ਦਿੰਦੇ ਸੀ ਜਿਵੇਂ ਕਿਸੇ ਬਜ਼ੁਰਗ ਤੋਂ ਪਾਣੀ ਨਾ ਚੱਕਿਆ ਜਾਵੇ ਘਰ ਦੇ ਮੁਖੀਏ ਤੋਂ ਤਾਂ ਉਹ ਬੱਚਿਆਂ ਨੂੰ ਨਾਲ ਲੈ ਜਾਂਦੇ ਸੀਗੇ ਅਤੇ ਬੱਚੇ ਵੀ ਉਹਨਾਂ ਦੇ ਨਾਲ ਨਾ ਪਾਣੀ ਚੁਕਾ ਦਿੰਦੇ ਸੀਗੇ ਤਾਂ ਉਦੋਂ ਨਾਲੇ ਪਾਣੀ ਹੈ ਜਿਹੜਾ ਉਹ ਸੀਮਿਤ ਮਾਤਰਾ ਵਿੱਚ ਹੀ ਵਰਤਿਆ ਜਾਂਦਾ ਸੀਗਾ ਤਾਂ ਜੋ ਵੀ ਅੱਜ ਕੱਲ੍ਹ ਤਾਂ ਜਿਵੇਂ ਕਹਿ ਰਹੇ ਨੇ ਪਾਣੀ ਹੈ ਜਿਹੜਾ ਸਾਡਾ ਧਰਤੀ ਤੋਂ ਖਤਮ ਹੋ ਰਿਹਾ ਉਹ ਖੂਹ 'ਚੋਂ ਕੱਢਦੇ ਸੀ ਤਾਂ ਉਹਨਾਂ ਦਾ ਜ਼ੋਰ ਲੱਗਦਾ ਸੀਗਾ ਇਸ ਕਰਕੇ ਸਾਰੇ ਨੇ ਜਿਹੜੇ ਪਾਣੀ ਘੱਟ ਤੋਂ ਘੱਟ ਉਹਦੀ ਜਿੰਨੀ ਕੁ ਵਰਤੋਂ ਕਰ ਸਕਣ ਜਾਂ ਜਿਨ੍ਹਾਂ ਕੁ ਉਨ੍ਹਾਂ ਲਈ ਜ਼ਰੂਰੀ ਸਮਝਿਆ ਜਾਂਦਾ ਬਸ ਉਨ੍ਹਾਂ ਕੁ ਵਰਤੋਂ ਕਰਦੇ ਸੀ ਜਿਵੇਂ ਅੱਜ ਕੱਲ੍ਹ ਤਾਂ ਲੋਕ ਪਾਣੀ ਹੈ ਜਿਹੜਾ ਗੱਡੀਆਂ ਧੋਈ ਜਾਂਦੇ ਨੇ ਮੋਟਰਸਾਈਕਲ ਪਾਈਪ ਖੁੱਲ੍ਹੇ ਚਲੀ ਜਾਂਦੇ ਨੇ ਉਸ ਸਮੇਂ ਇਹ ਨਹੀਂ ਸੀਗਾ ਉਹਦੇ ਨਾਲ ਕਿ ਪਾਣੀ ਹੈ ਜਿਹੜਾ ਸਾਡਾ ਧਰਤੀ ਦੇ ਵਿੱਚ ਬਚਿਆ ਹੋਇਆ ਸੀਗਾ ਅਤੇ ਇਹ ਵੀ ਕਹਿ ਸਕਦੇ ਹਾਂ ਆਪਾਂ ਜਿਹੜਾ ਖੂਹ ਆ ਉਹ ਪਿੰਡ 'ਚ ਤਾਂ ਇੱਕ ਸਾਂਝਾ ਖੂਹ ਹੁੰਦਾ ਸੀ ਪਰ ਖੇਤੀ ਕਰਨ ਲਈ ਹਰੇਕ ਦੇ ਅ ਖੇਤਾਂ ਦੇ ਵਿੱਚ ਅਲੱਗ ਅਲੱਗ ਖੂਹ ਹੁੰਦਾ ਸੀ ਤਾਂ ਉਹ ਜਿਹੜਾ ਖੂਹ ਆ ਸਭ ਤੋਂ ਪਹਿਲਾਂ ਉਹ ਵੀ ਪਹਿਲਾਂ ਇਵੇਂ ਕਿ ਪਾਣੀ ਦੀਆਂ ਬਾਲਟੀਆਂ ਖਿੱਚਦੇ ਸੀ ਲੋਕ ਹੈ ਨਾ ਪਾਣੀ ਦੀ ਬਾਲਟੀ ਖਿੱਚਣ ਦੇ ਨਾਲ ਇਵੇਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸੀ ਪਰ ਉਹਦੇ ਨਾਲ ਟਾਈਮ ਆ ਜਿਹੜਾ ਬਹੁਤ ਜ਼ਿਆਦਾ ਲੱਗਦਾ ਹੁੰਦਾ ਸੀਗਾ ਕਿੰਨੇ ਦਿਨਾਂ ਅ ਮਤਲਬ ਆਪਣੇ ਖੇਤਾਂ ਨੂੰ ਪਾਣੀ ਲਾਉਂਦਿਆਂ ਨੂੰ ਲੰਘ ਜਾਂਦੇ ਸੀ ਫਿਰ ਹੌਲੀ ਹੌਲੀ ਉਹਨਾਂ ਨੇ ਸਕੀਮ ਲਗਾਈ ਹੈ ਨਾ ਉਹਨਾਂ ਨੇ ਫਿਰ ਆਪਣੇ ਖੂਹ ਦੇ ਉੱਪਰ ਟਿੰਡਾ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਟਿੰਡਾਂ ਲਾਈਆਂ ਸੀਗੀਆਂ ਟਿੰਡਾਂ ਨੂੰ ਬਲਦ ਨੇ ਜਿਹੜੇ ਉਹ ਬਲਦ ਆਲੇ ਦੁਆਲੇ ਮਤਲਬ ਖੂਹ ਦੇ ਗੇੜਾ ਦਿੰਦੇ ਸੀਗੇ ਅਤੇ ਟਿੰਡਾਂ ਦੇ ਵਿੱਚੋਂ ਪਾਣੀ ਨਿਕਲੀ ਜਾਂਦਾ ਸੀ ਬਲਦ ਨੂੰ ਫਿਰ ਉਹ ਘੁਮਾਉਂਦੇ ਸੀਗੇ ਕਿਸਾਨ ਤਾਂ ਫਿਰ ਜਿਹੜਾ ਪਾਣੀ ਸੀ ਉਹ ਇਵੇਂ ਨਿਕਲਣਾ ਸ਼ੁਰੂ ਹੋ ਗਿਆ ਹੈ ਨਾ ਅਤੇ ਹੌਲੀ ਹੌਲੀ ਜਿਵੇਂ ਆਪਾਂ ਅੱਜ ਕੱਲ੍ਹ ਦੇਖਦੇ ਹੀ ਹਾਂ ਜਿਹੜਾ ਪਾਣੀ ਆ ਖੂਹ ਆ ਸੋਰੀ ਇਹ ਤਾਂ ਖਤਮ ਹੀ ਹੋ ਗਏ ਕਿਤੇ ਦੇਖਣ ਨੂੰ ਵੀ ਨਹੀਂ ਇਹ ਮਿਲਦੇ ਹੈਗੇ ਜਿਹੜੇ ਪਿੰਡ ਦੇ ਲੋਕ ਨੇ ਇਹ ਪਾਣੀ ਜ਼ਿਆਦਾਤਰ ਨਾ ਆਪਣਾ ਵਰਤੋਂ ਲਈ ਹੀ ਲੈ ਕੇ ਆਉਂਦੇ ਸੀ ਜਿਵੇਂ ਜਿਹੜਾ ਜਿੰਨੀ ਕੁ ਜ਼ਰੂਰੀ ਵਰਤੋਂ ਆ ਨਾ ਤਾਂ ਉਹ ਘਰਾਂ ਦੇ ਵਿੱਚ ਜ਼ਿਆਦਾ ਕੱਪੜੇ ਧੋਂਦੇ ਸੀ ਨਾ ਹੀ ਉਹ ਜਿਹੜੇ ਬੰਦੇ ਨੇ ਉਹ ਖੇਤਾਂ ਦੇ ਵਿੱਚ ਇਸ਼ਨਾਨ ਪਾਣੀ ਕਰ ਆਉਂਦੇ ਹੁੰਦੇ ਸੀਗੇ ਬੀਬੀਆਂ ਨੇ ਜਿਹੜੀਆਂ ਉਹ ਥੋੜ੍ਹਾ ਬਹੁਤਾ ਪਾਣੀ ਲਿਆਉਂਦੀਆਂ ਸੀ ਘਰਾਂ 'ਚ ਇਸ਼ਨਾਨ ਪਾਣੀ ਕਰਨ ਦਾ ਆਪਣੇ ਬੱਚਿਆਂ ਨੂੰ ਨਵਾਉਣ ਦਾ ਜਦਕਿ ਕੱਪੜੇ ਧੋਣੇ ਆ ਉਹ ਆਪਣੇ ਖੇਤਾਂ 'ਚ ਜ਼ਿਆਦਾਤਰ ਤਾਂ ਜੋ ਉੱਥੇ ਟਿਊਬਵੈਲ ਹੁੰਦੇ ਸੀਗੇ ਟਿਊਬਵੈਲ ਦੇ ਨਾਲ ਜਿਵੇਂ ਖੂਹਾਂ 'ਚੋ ਪਾਣੀ ਕੱਢਦੇ ਸੀਗੇ ਨਾ ਉਹਦੇ ਨਾਲ ਪਾਣੀ ਠੀਕ ਨਿਕਲ ਆਉਂਦਾ ਸੀਗਾ ਨਹੀਂ ਖੂਹ ਤੋਂ ਤਾਂ ਪਾਣੀ ਪੀਣ ਜੋਗਾ ਜਾਂ ਘਰ ਦੀ ਵਰਤੋਂ ਜੋਗਾ ਹੀ ਭਰਿਆ ਜਾਂਦਾ ਸੀਗਾ ਬਸ ਇਵੇਂ ਚੱਲਦੇ ਚੱਲਦੇ ਸਾਰਾ ਕੁਛ ਹੁਣ ਦੇਖਣ ਨੂੰ ਸਾਨੂੰ ਤਾਂ ਕੋਈ ਖੂਹ ਵੀ ਨਹੀਂ ਨਜ਼ਰ ਆਉਂਦਾ ਨਾ ਹੀ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਖੂਹ ਹੁੰਦੇ ਕੀ ਨੇ ਤਾਂ ਜਦੋਂ ਬੱਚੇ ਹੁਣ ਅੱਜ ਦੇ ਸਮੇਂ 'ਚ ਕੋਈ ਖੂਹ ਆ ਜਿਹੜਾ ਉਹ ਪ੍ਰਦਰਸ਼ਨੀ 'ਚ ਹੀ ਦਿਖਾਏ ਜਾਂਦੇ ਨੇ ਵੀ ਪੁਰਾਣੇ ਸਮੇਂ 'ਚ ਇਵੇਂ ਦੇ ਖੂਹ ਹੁੰਦੇ ਸੀ ਤਾਂ ਉਹਨਾਂ ਨੂੰ ਬੱਚੇ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਹੁਣ ਤੁਸੀਂ ਆਪ ਹੀ ਸੋਚੋ ਜੇ ਉਹ ਖੂਹ ਨੇ ਜਿਹੜੇ ਅੱਜ ਵੀ ਹੁੰਦੇ ਤਾਂ ਬੱਚਿਆਂ ਨੂੰ ਦੇਖਣ 'ਚ ਉਹਨਾਂ ਚੋਂ ਪਾਣੀ ਕੱਢਣ 'ਚ ਕਿੰਨਾ ਮਜ਼ਾ ਆਉਂਦਾ ਉਹ ਕਿੰਨਾ ਆਨੰਦਿਤ ਹੁੰਦੇ ਹੈ ਨਾ ਪਰ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਜਿਵੇਂ ਅੱਜ ਅੱਜ ਦੇ ਸਮੇਂ 'ਚ ਅਸੀਂ ਦਿਖਾਵੇ 'ਚ ਰੱਖਦੇ ਹਾਂ ਵਿਆਹਾਂ ਦੇ ਵਿੱਚ ਜਿਵੇਂ ਇੱਕ ਪਾਸੇ ਹੈ ਨਾ ਸ਼ੋਪੀਸ ਕਹਿ ਲੋ ਦਿਖਾਏ ਜਾਂਦੇ ਨੇ ਵੀ ਇਹ ਪੁਰਾਤਨ ਸੱਭਿਆਚਾਰ ਦੀ ਝਲਕ ਦਿਖਾਈ ਜਾਂਦੀ ਆ ਪਰ ਉਹ ਹੁੰਦਾ ਨਹੀਂ ਆ ਸਿਰਫ ਇੱਕ ਝਲਕ ਹੀ ਦਿਖਾਉਂਦੇ ਨੇ ਵੀ ਇਵੇਂ ਦਾ ਖੂਹ ਹੁੰਦਾ ਸੀਗਾ ਪਰ ਮੈਂ ਚਾਹੁੰਦੀ ਹਾਂ ਵੀ ਸਾਡੇ ਬੱਚਿਆਂ ਨੂੰ ਵੀ ਇੱਕ ਅੱਧਾ ਕੋਈ ਖੂਹ ਇਵੇਂ ਦਾ ਹੋਵੇ ਠੀਕ ਆ ਖੂਹ ਕੱਚੇ ਹੁੰਦੇ ਸੀ ਪਹਿਲਾਂ ਕਿਉਂਕਿ ਉਹਦੇ ਵਿੱਚ ਕਿਸੇ ਦੇ ਡਿੱਗਣ ਦਾ ਵੀ ਡਰ ਹੁੰਦਾ ਸੀਗਾ ਕਿਉਂਕਿ ਉਹਦੇ ਉੱਪਰ ਘੱਟ ਹੀ ਬਣੇ ਹੁੰਦੇ ਸੀਗੇ ਸਾਡੇ ਖੇਤਾਂ 'ਚ ਵੀ ਇੱਕ ਖੂਹ ਆ ਉਹਦੇ ਉੱਪਰ ਮੋਡ ਨਹੀਂ ਬਣੀ ਹੋਈ ਅਤੇ ਪਰ ਜਦ ਕਿ ਉਹ ਰਿਸਕੀ ਕੰਮ ਆ ਉਹ ਖੂਹ ਦੇ ਵਿੱਚ ਫਿਰ ਖੇਤਾਂ ਵਾਲੇ 'ਚ ਜਿਹਦੇ ਵਿੱਚ ਕੋਈ ਡੰਗਰ ਪਸ਼ੂ ਕੁਛ ਵੀ ਕੋਈ ਵੀ ਜਾਨਵਰ ਆ ਉਹਦੇ ਵਿੱਚ ਡਿੱਗ ਸਕਦਾ ਅਤੇ ਡਿੱਗ ਸਕਦੇ ਉਹਦੀ ਮੌਤ ਵੀ ਹੋ ਸਕਦੀ ਹੈ ਨਾ ਖੂਹ ਦੇ ਵਿੱਚ ਜੇ ਕੋਈ ਡਿਗ ਜਾਂਦੀ ਹੈ ਚੀਜ਼ ਜਾਨਵਰ ਵਗੈਰਾ ਨੂੰ ਕਿਹੜਾ ਪਤਾ ਹੁੰਦਾ ਵੀ ਇੱਥੇ ਖੂਹ ਆ ਤਾਂ ਉਹ ਨ ਦੀ ਡੈਥ ਵੀ ਹੋ ਜਾਂਦੀ ਆ ਅਤੇ ਇਸ ਕਰਕੇ ਉਹ ਖੂਨ ਨੇ ਜਿਹੜੇ ਹੁਣ ਮੋਸਟਲੀ ਆ ਪਿੰਡਾਂ 'ਚ ਸਾਰੇ ਖਤਮ ਕਰ ਦਿੱਤੇ ਨੇ ਜਾਂ ਭਰ ਦਿੱਤੇ ਗਏ ਨੇ ਪਰ ਮੈਨੂੰ ਇੱਕ ਖੁਸ਼ੀ ਵੀ ਇਹ ਦੱਸਦਿਆਂ ਹੋਇਆ ਕਿ ਸਾਡੇ ਖੇਤ ਵਿੱਚ ਹਜੇ ਵੀ ਇੱਕ ਖੂਹ ਆ ਜਿਹੜਾ ਉਹ ਹੈਗਾ